ਬਦਲਦੇ ਸਵਾਦਾਂ ਅਤੇ ਗਲੋਬਲ ਪ੍ਰਭਾਵ ਨੂੰ ਦਰਸਾਉਣ ਲਈ ਪੰਜਾਬ ਪੇਂਡੂ ਦੀ ਕਲਾ ਅਤੇ ਸ਼ਿਲਪਕਾਰੀ ਵਿਕਸਿਤ ਹੁੰਦੀ ਹੈ ਇਸ ਵਿਚ ਸਰਕਾਰ ਅਤੇ ਐਨਜੀਓ ਦਾ ਕਾਫੀ ਵੱਡਾ ਯੋਗਦਾਨ ਰਹਿੰਦਾ ਹੈ ਇਸ ਸਰਕਾਰ ਅਤੇ ਐਨਜੀਓ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਚਲਾਉਂਦੀਆਂ ਹਨ ਜਿਸ ਵਿੱਚ ਲੋਕਾਂ ਨੂੰ ਇਹ ਜਾਂਚ ਦਿੱਤੀ ਜਾਂਦੀ ਹੈ ਕਿ ਉਹ ਕਿਸ ਤਰੀਕੇ ਨਾਲ ਆਪਣੀ ਕਲਾਕਾਰੀ ਨੂੰ ਵਧੀਆ ਤਰੀਕੇ ਨਾਲ ਹੋਰ ਅੱਗੇ ਲੈ ਕੇ ਜਾਣ ਜਿਸ ਨਾਲ ਉਹ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਦਿਖਾਈ ਜਾਏ ਅਤੇ ਲੋਕ ਉਸ ਵੱਲ ਵੱਧ ਆਉਣ ਇਸ ਵਿੱਚ ਇਹ ਵੀ ਸ ਦੱਸਿਆ ਜਾਂਦਾ ਹੈ ਲੋਕਾਂ ਨੂੰ ਕਿ ਤੁਸੀਂ ਸਿਰਫ ਵਿਦੇਸ਼ੀ ਚੀਜ਼ਾਂ ਵੱਲ ਹੀ ਨਾ ਆਕਰਸ਼ਿਤ ਹੋ ਬਲਕਿ ਆਪਣੀ ਸੰਸਕ੍ਰਿਤਿਕ ਚੀਜ਼ਾਂ ਨੂੰ ਵੀ ਅੱਗੇ ਲੈ ਕੇ ਜਾਓ ਤਾਂ ਕਿ ਵਿਦੇਸ਼ੀ ਲੋਕ ਤੁਹਾਡੀ ਚੀਜ਼ਾਂ ਵੱਲ ਆਉਣ